ਅੱਜ ਦੇ ਸਮੇਂ ਵਿੱਚ ਪੰਜਾਬੀ ਹਿੰਦੀ ਅੰਗਰੇਜ਼ੀ ਵਿੱਚ ਬਹੁਤ ਸਾਰੇ ਗੀਤ ਗਾਏ ਜਾਂਦੇ ਹਨ ਪਰ ਮੈਨੂੰ ਪੰਜਾਬੀ ਗੀਤ ਵਧੀਆ ਲੱਗਦੇ ਹਨ ਪੰਜਾਬੀ ਗੀਤਕਾਰਾਂ ਵਿੱਚ ਮੈਨੂੰ ਸਤਿੰਦਰ ਸਰਤਾਜ ਨਿਮਰਤ ਖਹਿਰਾ ਅਤੇ ਅਮਰਿੰਦਰ ਗਿੱਲ ਵਧੀਆ ਲੱਗਦੇ ਹਨ ਨਿਮਰਤ ਖਹਿਰਾ

ਮਾਝੇ ਲੈ ਲਹਿਜੇ ਵਿੱਚ ਬੋਲਦੀ ਹੈ ਅਤੇ ਸਤਿੰਦਰ ਸਰਤਾਜ ਦੇ ਗੀਤ ਵਿੱਚ ਕੋਈ ਨਾ ਕੋਈ ਮਤਲਬ ਹੁੰਦਾ ਹੈ ਅਤੇ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਮਿਠਾਸ ਅਤੇ ਸੁਰੀਲਾਪਨ ਹੁੰਦਾ ਹੈ ਉਸ ਦਾ ਇੱਕ ਗੀਤ ਜੋ ਕਿ ਬਹੁਤ ਚੱਲਿਆ ਹੈ ਰੌਣਕ ਹੋਜੂ ਘੱਟ ਵੇ ਚਲ ਮੇਲੇ ਨੂੰ ਚਲੀਏ ਇਸ ਉੱਤੇ ਕਈ ਲੋਕ ਭੰਗੜਾ ਵੀ ਪਾਉਂਦੇ ਹਨ ਅਤੇ ਉਸਦੇ ਬਹੁਤ ਸਾਰੀ ਗੀਤਾਂ 'ਤੇ ਭੰਗੜਾ ਵੀ ਪਾਇਆ ਜਾਂਦਾ ਹੈ ਪਰ ਮੈਨੂੰ ਇਹ ਗੀਤ ਬਹੁਤ ਵਧੀਆ ਲੱਗਦਾ ਹੈ